ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਸੰਚਾਲਨ ਨੂੰ ਨਿਯੰਤਰਨ ਕਰਨ ਲਈ ਰਿਜਰਵ ਬੈਂਕ ਇੱਕ ਨੋਡਲ ਏਜੰਸੀ ਹੈ ਕਿਉਂਕਿ ਜੋ ਵੀ ਲੋਕਾਂ ਦੇ ਪੈਸੇ ਬੈਂਕ ਜਾਂ ਵਿੱਤੀ ਸੰਸਥਾਵਾਂ ਇਕੱਠੇ ਕਰਦੀਆਂ ਹਨ ਉਹਨਾਂ ਦਾ ਇੰਟਰਸਟ ਵਾਚ ਕਰਨਾ ਵੀ ਜ਼ਰੂਰੀ ਹੁੰਦਾ ਹੈ ਤਾਂ ਕਿ ਉਹਨਾਂ ਦੇ ਪੈਸੇ ਸੇਫ ਰਹਿਣ ਇਸ ਲਈ ਰਿਜ਼ਰਵ ਬੈਂਕ ਵੱਲੋਂ ਇਹਨਾਂ ਬੈਂਕਾਂ 'ਤੇ ਔਰ ਇਹ ਵਿੱਤੀ ਸੰਸਥਾਵਾਂ 'ਤੇ ਨਿਗਰਾਨੀ ਕੀਤੀ ਜਾਂਦੀ ਹੈ ਔਰ ਕਾਨੂੰਨ ਦੇ ਵਿੱਚ ਰਿਜ਼ਰਵ ਬੈਂਕ ਨੂੰ ਇੱਕ ਬੈਂਕਾਂ ਦਾ ਬੈਂਕ ਔਰ ਬੈਂਕਾਂ ਦਾ ਬਾਪ ਕਿਹਾ ਜਾਂਦਾ ਹੈ ਔਰ ਇਹ ਬੈਂਕ ਨੂੰ ਇਹਨਾਂ ਦੇ ਨਿਯਮਾਂ ਦਾ ਪਾਲਨ ਕਰਨਾ ਪੈਂਦਾ ਹੈ ਔਰ ਨਕਸੀਜ ਦੇ ਵਿੱਚ ਵੀ ਬੈਂਕਾਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਦੇਣ ਦਾ ਅਧਿਕਾਰ ਰਿਜ਼ਰਵ ਬੈਂਕ ਨੂੰ ਦਿੱਤਾ ਗਿਆ ਹੈ ਇਸੇ ਤਰ੍ਹਾਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਵੀ ਇਰਡਾ ਇੱਕ ਏਜੰਸੀ ਹੈ ਜਿਹੜੀ ਕਿ ਇਨਸ਼ੋਰੈਂਸ ਰੈਗੂਲੇਟਰੀ ਅਥੋਰਟੀ ਹੈ ਔਰ ਇੰਸ਼ੋਰੈਂਸ ਦੇ ਜਿਹੜੇ ਕਾਰੋਬਾਰ ਕਰਦੇ ਹਨ ਭਾਵੇਂ ਉਹ ਲਾਈਫ ਇੰਸ਼ੋਰੈਂਸ ਦਾ ਹੋਵੇ ਜਨਰਲ ਇੰਸ਼ੋਰੈਂਸ ਦਾ ਹੋਵੇ ਜਾਂ ਆਪਣਾ ਹੈਲਥ ਇੰਸ਼ੋਰੈਂਸ ਦਾ ਹੋਵੇ ਲੋਕਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਔਰ ਭਾਰਤ ਵਿੱਚ ਇਸ ਦੀ ਬਹੁਤ ਜ਼ਿਆਦਾ ਪਰਸੈਂਟੇਜ ਘੱਟ ਹੈ ਲੋਕ ਬੀਮਾ ਕਰਾਉਣ ਦੇ ਵਿੱਚ ਇੰਟਰਸਟ ਘੱਟ ਲੈਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਸੋਸ਼ਲ ਸਕਿਉਰਟੀ ਦੀ ਦਿੱਕਤ ਆਉਂਦੀ ਹੈ